ਹਾਂ ਮੈਂ ਕਈ ਵਾਰ ਫਿਲਮੀ ਕੈਮਰੇ ਨਾਲ ਸ਼ੂਟਿੰਗ ਕੀਤੀ ਹੈ ਅਤੇ ਕਈ ਫਿਲਮਾਂ ਵੀ ਬਣਾਈਆਂ ਹਨ ਅਤੇ ਮੇਰਾ ਤਜਰਬਾ ਬਹੁਤ ਵਧੀਆ ਰਿਹਾ ਹੈ ਡਿਜ਼ੀਟਲ ਕੈਮਰੇ ਆਉਣ ਨਾਲ ਬੜਾ ਫੋਟੋਗ੍ਰਾਫਰੀ ਸੌਖੀ ਹੋ ਗਈ ਹੈ ਇਸ ਨੂੰ ਕੰਪਿਊਟਰ ਲੈਪਟੋਪ ਅਤੇ ਮੋਬਾਇਲ ਵਿੱਚ ਵੀ ਆਪਾਂ ਵਰਤੋਂ ਕਰ ਸਕਦੇ ਹਾਂ ਅਤੇ ਆਪਣਾ ਡਾਟਾ ਵੀ ਸੌਖਾ ਸਾਂਭਿਆ ਜਾ ਸਕਦਾ ਹੈ ਪਹਿਲਾਂ ਕੀ ਟਾਈਮ ਹੁੰਦਾ ਸੀ ਕਿ ਜਦੋਂ ਰੋਲ ਵਾਲੇ ਕੈਮਰੇ ਆਉਂਦੇ ਸਨ ਤਾਂ ਉਹਨਾਂ ਦੇ ਨੈਗਟਿਵ ਹੁੰਦੇ ਸੀ ਉਹ ਨੈਗਟਿਵ ਨੂੰ ਸਾਂਭ ਸੰਭਾਲ ਕਰਨੀ ਪੈਂਦੀ ਸੀ ਬੜੇ ਧਿਆਨ ਨਾਲ ਰੱਖਣੇ ਪੈਂਦੇ ਸੀ ਉਹ ਜਿਹੜੇ ਨੈਗਟਿਵ ਖ਼ਰਾਬ ਹੋ ਜਾਣ ਤਾਂ ਫਿਰ ਉਹਨਾਂ ਦੀ ਵਰਤੋਂ ਨਹੀਂ ਹੁੰਦੀ ਹੀ ਅਤੇ ਫੋਟੋਆਂ ਵੀ ਖ਼ਰਾਬ ਹੀ ਰਹਿੰਦੀਆਂ ਸੀ ਬਣਦੀਆਂ ਨਹੀਂ ਹਨ ਹੁਣ ਡਿਜ਼ੀਟਲ ਕੈਮਰੇ ਆਉਣ ਨਾਲ ਇਹ ਹੋ ਗਿਆ ਹੈ ਕਿ ਸਾਡਾ ਡਾਟਾ ਸਾਂਭਣਾ ਸੌਖਾ ਹੋ ਗਿਆ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਅਸੀਂ ਫੋਟੋਗ੍ਰਾਫਰੀ ਵੀ ਕਰਦੇ ਹਾਂ ਅਤੇ ਇਹਨਾਂ ਡਿਜ਼ੀਟਲ ਕੈਮਰਿਆਂ ਦਾ ਆਨੰਦ ਵੀ ਮਾਣਦੇ ਹਾਂ